ਭਾਰਤ ਵਿੱਚ ਖੇਡਾਂ ਤਾਂ ਬਹੁਤ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਮਾਨਤਾ ਦੀ ਲੋੜ ਹੈ ਜਿਵੇਂ ਕਿ ਫੁੱਟਬੋਲ ਖੋ ਖੋ ਹੈਂਡਬੋਲ ਵਾਲੀਵੋਲ ਅਤੇ ਹੋਰ ਵਧੇਰੀਆਂ ਗੇਮਾਂ ਇਹਨਾਂ ਗੇਮਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦੀ ਇਸ ਕਰਕੇ ਲੋੜ ਹੈ ਕਿਉਂਕਿ ਸਾਡੇ ਇਲਾਕੇ ਵਿੱਚ ਬਹੁਤ ਬੱਚੇ ਹਨ ਜੋ ਕਿ ਇਹਨਾਂ ਗੇਮਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਖੇਡਦੇ ਹਨ ਉਹ ਬੱਚੇ ਇਸ ਕਰਕੇ ਵਧੀਆ ਪ੍ਰੈਕਟਿਸ ਨਹੀਂ ਕਰਦੇ ਕਿਉਂਕਿ ਇਹ ਗੇਮਾਂ ਸਾਡੇ ਅੰਤਰਰਾਸ਼ਟਰੀ ਪੱਧਰ ਤੱਕ ਨਹੀਂ ਹਨ ਜੇ ਆਪਾਂ ਇਸ ਗੇਮਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਈਏ ਤਾਂ ਸਾਡੇ ਬੱਚੇ ਇਹਨਾਂ ਗੇਮਾਂ ਨੂੰ ਖੇਡ ਕੇ ਆਪਣੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਬਹੁਤ ਹੀ ਮਦਦ ਕਰਨਗੇ ਅਤੇ ਸਭ ਨੂੰ ਇਹ ਚੀਜ਼ ਸੁਣ ਕੇ ਅਤੇ ਦੇਖ ਕੇ ਬਹੁਤ ਹੀ ਵਧੀਆ ਲੱਗੇਗਾ